ਜਾ ਆਵਾਜਾਈ ਦੇ ਸਾਧਨ ਅੱਜ ਦੇ ਸਮੇਂ ਵਿੱਚ ਮੋਟਰਸਾਈਕਲ ਗੱਡੀ ਸਕੂਟਰ ਬੱਸਾਂ ਰੇਲ ਗੱਡੀਆਂ ਜਹਾਜ ਆਦਿ ਦੀਆਂ ਵਰਤੋਂ ਕਰਦੇ ਹਨ ਜੇਕਰ ਮੈਂ ਕਿੱਥੇ ਵੀ ਨੇੜੇ ਵੱਲ ਦਾ ਸੈਰ ਕਰਨੀ ਹੋਵੇ ਤਾਂ ਮੈਂ ਸਾਈਕਲ 'ਤੇ ਜਾਂਦਾ ਹਾਂ ਅਤੇ ਮੈਂ ਪਰਸੋਂ ਬੱਸ ਵਿੱਚ ਚੰਡੀਗੜ੍ਹ ਜਾਣ ਦਾ ਸਫ਼ਰ ਕੀਤਾ ਅਤੇ ਮੈਨੂੰ ਏ ਸੀ ਬੱਸ ਮਿਲ ਗਈ ਤਾਂ ਉਸ ਬੱਸ ਦਾ ਸਫ਼ਰ ਜਮਾਂ ਵੀ ਖੇਚਲ ਉਸ ਬੱਸ ਵਿੱਚ ਮੈਨੂੰ ਜਮਾਂ ਵੀ ਖੇਚਲ ਨਹੀਂ ਹੋਈ ਅਤੇ ਮੈਂ ਸਹੀ ਸਲਾਮਤ ਪਹੁੰਚਿਆ ਉਹ ਉਹ ਬੱਸ ਮੇਰੇ ਲਈ ਬਹੁਤ ਹਾਨੀਕਾਰਕ ਹੈ ਅਤੇ ਹੋਰ ਵੀ ਮੈਂ ਜੇਕਰ ਹੋਰ ਵੀ ਕਈ ਸੇਵਾਵਾਂ ਹਨ ਅਤੇ ਲੋਕ ਕਈ ਜਹਾਜਾਂ ਦੀਆਂ ਸੈਰਾਂ ਕਰਦੇ ਹਨ ਕਈ ਬੱਸਾਂ ਦੀਆਂ ਕਈ ਗੱਡੀਆਂ ਮੋਟਰਸਾਈਕਲ ਕਾਰਾਂ ਦੀਆਂ ਆਦਿ ਦੀਆਂ ਸੈਰਾਂ ਕਰਦੇ ਹਨ